ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਕੋਮਲ ਢਾਬੇ ਤੋਂ ਜੀ ਸ਼ਾਹੀ ਪਨੀਰ ਅਤੇ ਦੋ ਚਾਰ ਆਈਟਮਾਂ ਹੋਰ ਮੰਗਵਾਈਆਂ ਸੀ ਜੀ ਅਤੇ ਮੈਂ ਉਸ ਔਡਰ ਦਾ ਦੀ ਪੇਮੈਂਟ ਕਰਨ ਲੱਗੀ ਸੀਗੀ ਅਤੇ ਹੁਣ ਉਹ ਕਿਤੇ ਨੈਟਵਰਕ ਪ੍ਰੋਬਲਮ ਕਰਕੇ ਮੇਰੇ ਤੋਂ ਉਹ ਪੇਮੈਂਟ ਕਰ ਨਹੀਂ ਹੋ ਰਹੀ ਭਾਅ ਜੀ ਅਤੇ ਤੁਸੀਂ ਹੋ ਸਕਦਾ ਤਾਂ ਜਦੋਂ ਬੰਦਾ ਤੁਹਾਡਾ ਪੇਮੈਂਟ ਔਡਰ ਦੇਣ ਆਊਗਾ ਤਾਂ ਮੈਂ ਜਦੇ ਪੇਮੈਂਟ ਕਰ ਦੂੰਗੀ ਜੀ ਥੈਂਕ ਯੂ ਵੈਰੀ ਮੱਚ